ਜੀ ਐਸ ਟੀ ਇੱਕ ਅਨਡਰੈਕਟ ਟੈਕਸ ਹੈ ਜੋ ਹਰ ਵਿਅਕਤੀ ਉੱਤੇ ਸਿੱਧਾ ਹੀ ਨਹੀਂ ਲਗਾਇਆ ਜਾਂਦਾ ਇਹ ਟੈਕਸ ਗਵਰਮੈਂਟ ਦੁਆਰਾ ਪਹਿਲਾਂ ਤੋਂ ਹੀ ਹਰ ਇੱਕ ਚੀਜ਼ 'ਤੇ ਲਗਾਇਆ ਜਾਂਦਾ ਹੈ ਜਿਸ ਵਿੱਚ ਕੋਈ ਵੀ ਡਿਸਕਾਊਂਟ ਸਾਨੂੰ ਨਹੀਂ ਮਿਲਦਾ ਸਾਨੂੰ ਇਸ ਟੈਕਸ ਤੋਂ ਆਪਣੀ ਜ਼ਿੰਮੇਵਾਰੀ ਮੰਨਣੀ ਚਾਹੀਦੀ ਹੈ ਜੀ ਐਸ ਟੀ ਦਾ ਮੇਨ ਮਕਸਦ ਦੇਸ਼ ਦਾ ਵਿਕਾਸ ਹੁੰਦਾ ਹੈ ਇਹ ਗਾਹਕਾਂ ਦੀ ਬਿਨਾਂ ਜਾਣਕਾਰੀ ਤੋਂ ਹੀ ਲਗਾਇਆ ਜਾਂਦਾ ਹੈ ਪਰ ਇਸਦੀ ਜਾਣਕਾਰੀ ਅਸੀਂ ਜਿਹੜੀ ਚੀਜ਼ ਖਰੀਦਦੇ ਹਾਂ ਉਸ ਉੱਤੇ ਲਿਖਿਆ ਹੁੰਦਾ ਹੈ ਇਹ ਜੀ ਐਸ ਟੀ ਸਾਨੂੰ ਬਿਜਲੀ ਦੇ ਬਿੱਲਾਂ 'ਤੇ ਵੀ ਲੱਗਦੀ ਹੈ